ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਕਮਲਪ੍ਰੀਤ ਕੌਰ ਪਿੰਡ ਘੁੱਦਾ ਤੋਂ ਗੱਲ ਕਰ ਰਹੀ ਹੈ ਸਰ ਮੈਂ ਸਵੇਰੇ ਹੀ ਇੱਕ ਆਰਡਰ ਕੀਤਾ ਸੀ ਆਰਡਰ ਇੱਕ ਪੀਜ਼ਾ ਅਤੇ ਕੁਛ ਕੋਲਡ ਡਰਿੰਕਸ ਸੀ ਅਤੇ ਸਰ ਮੈਨੂੰ ਉਹ ਆਰਡਰ ਕੈਂਸਲ ਕਰਨਾ ਪੈਣਾ ਕਿਉਂਕਿ ਮੇਰੇ ਕੁਛ ਰਿਸ਼ਤੇਦਾਰਾਂ ਨੇ ਆਉਣਾ ਸੀ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਕੰਮ ਹੋ ਗਿਆ ਉਹ ਆ ਨਹੀਂ ਸਕਦੇ ਅਤੇ ਉਹਨਾਂ ਦਾ ਬਾਰ ਬਾਰ ਫੋਨ ਆ ਰਿਹਾ ਵੀ ਅਸੀਂ ਕੱਲ੍ਹ ਹੀ ਆਵਾਂਗੇ ਸੋ ਮੈਂ ਨਹੀਂ ਚਾਹੁੰਦੀ ਵੀ ਉਹ ਮੇਰੇ ਵੀ ਖਾਣੇ ਦੀ ਬਰਬਾਦੀ ਹੋਵੇ ਕਿਰਪਾ ਕਰਕੇ ਤੁਸੀਂ ਮੇਰਾ ਆਰਡਰ ਆ ਜਿਹੜਾ ਕੈਂਸਲ ਕਰ ਦਿਓ ਸਰ ਤੁਹਾਡਾ ਜਿਹੜਾ ਖਾ ਰੈਸਟੋਰੈਂਟ ਹੈ ਇਹਦਾ ਜਿਹੜੀ ਕੋਈ ਵੀ ਆਈਟਮ ਮੈਨੂੰ ਬਹੁਤ ਪਸੰਦ ਆ ਮੈਂ ਦਿਲੋਂ ਬਹੁਤ ਚਾਹੁੰਦੀ ਹੈ ਵੀ ਤੁਹਾਡਾ ਬਹੁਤ ਵਧੀਆ ਖਾਣਾ ਹੁੰਦਾ ਹੈ ਪਰ ਮੈਂ ਖਾਣੇ ਦੀ ਬਰਬਾਦੀ ਵੀ ਨਹੀਂ ਕਰਨਾ ਚਾਹੁੰਦੀ ਕਿਰਪਾ ਕਰਕੇ ਮੇਰਾ ਆਰਡਰ ਕੈਂਸਲ ਕਰ ਦਿਓ ਆਪ ਜੀ ਦੀ ਅਤੀ ਧੰਨਵਾਦੀ ਹੋਵਾਂਗੀ ਧੰਨਵਾਦ